ਜਿੱਦਾਂ ਕੇ ਅੱਜ ਕੱਲ੍ਹ ਸੈਲਾਨੀ ਬਾਹਰ ਜਿਹੜੇ ਘੁੰਮਣ ਜਾਂਦੇ ਹਨ ਉਹ ਚਲੇ ਤਾਂ ਜਾਂਦੇ ਹਨ ਪਰ ਉਹ ਪਰੰਤੂ ਉਨ੍ਹਾਂ ਨੂੰ ਓੱਥੋਂ ਦੇ ਰੇਟ ਵਗੈਰਾ ਜੈਸੇ ਜਿੱਦਾਂ ਕੇ ਸਾਨੂੰ ਬਹੁਤ ਸਾਰੀ ਜ਼ਰੂਰਤ ਪੈਂਦੀ ਹੈ ਜਿੱਦਾਂ ਕੇ ਸਾਨੂੰ ਕਮਰੇ ਵੀ ਬੁੱਕ ਕਰਵਾਉਣੇ ਪੈਂਦੇ ਹੈ ਸਾਨੂੰ ਖਾਣ ਪੀਣ ਦੀਆਂ ਵਸਤੂਆਂ ਦੀ ਵੀ ਲੋੜ ਹੁੰਦੀ ਹੈ ਜਿਹਦੇ ਕੇ ਮਤਲਬ ਕੇ ਸਾਨੂੰ ਰੇਟ ਪਤਾ ਨਹੀਂ ਹੁੰਦਾ ਪਰੰਤੂ ਅਸੀਂ ਰੈਸਟੋਰੈਂਟ ਦੇ ਵਿੱਚ ਚਲੇ ਜਾਂਦੇ ਹਾਂ ਅਤੇ ਅਸੀਂ ਉੱਥੇ ਜਾਂਦੇ ਹਾਂ ਤਾਂ ਉੱਥੇ ਜਿਹੜੇ ਰੈਸਟੋਰੈਂਟ ਵਾਲੇ ਹੁੰਦੇ ਨੇ ਉਹ ਸਾਨੂੰ ਇੱਕ ਆਮ ਜਿਹੇ ਇਨਸਾਨ ਦੇਖ ਕੇ ਜਾਂ ਮਤਲਬ ਕੇ ਅਨ ਵੀ ਅਣਜਾਣ ਸਮਝਕੇ ਸਾਡੇ ਤੋਂ ਜ਼ਿਆਦਾ ਪੇ ਕਰਵਾ ਲੈਂਦੇ ਹਨ ਐਂਡ ਕਮਰਿਆਂ ਦਾ ਕਿਰਾਇਆ ਜ਼ਿਆਦਾ ਲੈ ਲੈਂਦੇ ਹਨ ਖਾਣ ਪੀਣ ਦਾ ਖ਼ਰਚਾ ਜਿਆਦਾ ਲੈ ਲੈਂਦੇ ਹਨ ਅਤੇ ਜਿਸ ਕਰਕੇ ਬਹੁਤ ਸਾਰੇ ਘੋਟਾਲੇ ਹੋ ਜਾਂਦੇ ਹਨ ਅਤੇ ਅਸੀਂ ਮਤਲਬ ਕੇ ਇੱਕ ਪ੍ਰਕਾਰ ਨਾਲ ਠੱਗੇ ਜਾਂਦੇ ਹਨ ਉਨ੍ਹਾਂ ਦੇ ਜਾਲ ਵਿੱਚ ਫਸ ਜਾਂਦੇ ਹਨ ਅਤੇ ਇਨ੍ਹਾਂ ਤੋਂ ਬਚਣ ਲਈ ਸਾਨੂੰ ਕੀ ਕਰਨਾ ਚਾਹੀਦਾ ਹੈ ਕਿ ਜਿਹੜੇ ਸਾਡੇ ਰਿਲੇਟਿਵਸ ਨੇ ਜਾਂ ਸਾਡੇ ਦੋਸਤ ਨੇ ਜਿਹੜੇ ਕਿ ਪਹਿਲਾਂ ਕਿਤੇ ਘੁੰਮਣ ਗਏ ਹੋਣ ਉਨ੍ਹਾਂ ਤੋਂ ਚੰਗੀ ਤਰ੍ਹਾਂ ਨੌਲੇਜ ਲੈ ਲੈਣੀ ਚਾਈਦੀ ਹਨ ਲੈ ਲੈਣੀ ਚਾਹੀਦੀ ਹੈ ਤਾਂ ਕੇ ਸਾਨੂੰ ਕੋਈ ਕਿਸੇ ਘੋਟਾਲੇ ਜਾਂ ਦਾ ਸਾਹਮਣਾ ਨਾ ਕਰਨਾ ਪਵੇ ਕਿਸੇ ਜਾਲ ਦੇ ਵਿੱਚ ਅਸੀਂ ਨਾ ਫਸੀਏ ਇੱਦਾਂ ਦੇ ਅਸੀਂ ਠੱਗੀ ਦੇ ਜਾਲ 'ਚ ਨਾ ਆ ਸਕੀਏ ਤਾਂ ਸਾਨੂੰ ਪਹਿਲਾਂ ਤੋਂ ਹੀ ਸਾਡੀ ਯਾਤਰਾ ਜਦੋਂ ਅਸੀਂ ਜਾਣ ਤੋਂ ਪਹਿਲਾਂ ਹੀ ਇਹ ਸਾਨੂੰ ਉੱਥੋਂ ਬਾਰੇ ਚੰਗੀ ਤਰ੍ਹਾਂ ਨੌਲੇਜ ਲੈ ਲੈਣੀ ਚਾਹੀਦੀ ਨੇ ਅਤੇ ਅਗਰ ਉੱਥੇ ਅਸੀਂ ਜਾਂਦੇ ਵੀ ਹਾਂ ਤਾਂ ਉੱਥੇ ਜਾ ਕੇ ਜਿਹੜੇ ਰੈਸਟੋਰੈਂਟ ਨੇ ਅਦਰ ਰੈਸਟੋਰੈਂਟ ਨੇ ਹੋਰ ਰੈਸਟੋਰੈਂਟ ਨੇ ਉਨ੍ਹਾਂ ਦੇ ਵਿੱਚ ਜਾ ਕੇ ਸਾਨੂੰ ਦੇਖ ਲੈਣਾ ਚਾਈਦਾ ਹੈ ਕਿ ਕੀ ਪ੍ਰਾਈਸ ਚੱਲ ਰਿਆ ਹੈ ਕਿੰਨਾ ਰੇਟ ਕਮਰਿਆਂ ਦਾ ਚੱਲ ਰਹੇ ਨੇ ਚੱਲ ਰਿਹਾ ਇੱਕ ਤੋਂ ਵੱਧ ਅਗਰ ਅਸੀਂ ਰੈਸਟੋਰੈਂਟਾਂ ਦੇ ਵਿੱਚ ਜਾ ਕੇ ਦੇਖਾਂਗੇ ਤਾਂ ਸਾਨੂੰ ਉਨ੍ਹਾਂ ਦੇ ਪ੍ਰਾਈਜ ਰੇਟ ਸਾਨੂੰ ਪਤਾ ਲੱਗਣਗੇ ਜਿਸ ਕਰਕੇ ਅਸੀਂ ਮਤਲਬ ਕੇ ਕੇ ਵਧੀਆ ਬਣਦੇ ਰੇਟ ਵਿੱਚ ਅਸੀਂ ਕਮਰਾ ਲੈ ਸਕਦੇ ਹਾਂ ਅੱਜ ਕੱਲ੍ਹ ਗੂਗਲ ਦੇ ਵਿ ਦੇ ਉੱਤੇ ਹਰ ਇਕ ਖਾਣ ਵਾਲੀ ਡਿਸ਼ ਦਾ ਰੇਟ ਅਵੇਲੇਵਲ ਹੈ ਕਮਰਿਆਂ ਦਾ ਰੂਮਸ ਦਾ ਰੇਟ ਅਵੇਲੇਵਲ ਹੈ ਸਭ ਕੁਛ ਨੈਟ ਦੇ ਉੱਤੇ ਅਵੇਲੇਵਲ ਹੈ ਤਾਂ ਅਸੀਂ ਅਸੀਂ ਆਪਾਂ ਗੂਗਲ ਦੀ ਸਹਾਇਤਾ ਦੇ ਨਾਲ ਵਿੱਚ ਨਾਲ ਵੀ ਅਸੀਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਅਤੇ ਅਸੀਂ ਘੁਟਾਲਿਆਂ ਤੋਂ ਬਚ ਸਕਦੇ